ਬਹੁਤ ਸਾਰੇ ਸਿਹਤਮੰਦ ਪਕਵਾਨ ਹਨ ਜੋ ਕਿ ਮੈਂ ਆਪਣੇ ਪਰਿਵਾਰ ਨੂੰ ਤਿਆਰ ਕਰਕੇ ਖਿਲਾਉਂਦੀ ਹਾਂ ਜਿਵੇਂ ਕਿ ਸੂਪ ਵੈਜ਼ੀਟੇਬਲ ਟਮਾਟੋ ਸੂਪ ਵੈਜ਼ੀਟੇਬਲ ਸੂਪ ਗਾਜਰ ਸੂਪ ਅੱਜ ਕੱਲ੍ਹ ਕਿਨੂੰ ਐਸ ਚੀਜ਼ਾਂ ਦੇ ਸਾਰੇ ਸੂਪ ਵਗੈਰਾ ਬਣਾ ਕੇ ਆਪਣੇ ਬੱਚਿਆਂ ਨੂੰ ਖਿਲਾਉਂਦੀ ਹਾਂ ਅਤੇ ਜਿਸ ਤਰਾਂ ਕਿ ਪੰਜੀਰੀ ਮੌਸਮ ਅਨੁਸਾਰ ਹੁਣ ਆਹ ਸਰਦੀ ਦਾ ਮੌਸਮ ਹੈ ਪੰਜੀਰੀ ਦੇਸੀ ਘਿਓ ਦੇ ਵਿੱਚ ਮ ਲੱਡੂ ਬਣਾ ਕੇ ਬੱਚਿਆਂ ਨੂੰ ਖਿਲਾਉਣੇ ਵੇਸਣ ਦੇ ਗਾਜਰ ਦਾ ਹਲਵਾ ਬਣਾਉਣਾ ਗਜਰੇਲਾ ਬਣਾਉਣਾ ਆਦਿ ਇਹੋ ਜਿਹੀਆਂ ਚੀਜ਼ਾਂ ਕਈ ਤਰ੍ਹਾਂ ਦੀਆਂ ਦੇਸੀ ਘਿਓ ਕੱਢਣਾ ਮੱਖਣੀ ਕੱਢਣੀ ਉਹਦੀ ਚਿੱਡੀ ਦੀ ਪੰਜੀਰੀ ਬਣਾਉਣੀ ਐਸੇ ਤਰ੍ਹਾਂ ਕਈ ਤਰ੍ਹਾਂ ਦੇ ਪਕਵਾਨ ਘਰ ਦੀਆਂ ਸਾਫ ਸੁਥਰੇ ਤਰੀਕੇ ਦੇ ਨਾਲ ਬ ਪਕਵਾਨ ਬਣਾਏ ਜਾਣ ਅਤੇ ਸਿਹਤਮੰਦ ਬਹੁਤ ਸਾਰੇ ਪਕਵਾਨ ਇਹੋ ਜਿਹੇ ਨੇ ਜਿਹੜੇ ਆਪਣੇ ਬੱਚਿਆਂ ਲਈ ਪਰਿਵਾਰ ਲਈ ਲਾਭਦਾਇਕ ਹੁੰਦੇ ਨੇ ਗਾਜਰ ਦੇ ਪਰੌਂਠੇ ਅ ਪਨੀਰ ਦੇ ਪਰੌਂਠੇ ਆਲੂ ਵਾਲੇ ਪਰੌਂਠੇ ਦੇਸੀ ਘਿਓ ਦੇ ਨਾਲ ਬਣਾਏ ਜਾਂਦੇ ਬਹੁਤ ਅੱਛੇ ਬਣਦੇ ਹਨ ਇਹ ਪਕਵਾਨ ਬਹੁਤ ਲਾਭਦਾਇਕ ਹੁੰਦੇ ਹਨ